ਕੋਈ ਵੀ ਰੈਸਪੀ ਹੈ ਜਦੋਂ ਅਸੀਂ ਬਣਾਉਂਦੇ ਤਾਂ ਉਹਦੇ ਵਿੱਚ ਜਿਹੜੇ ਮਸਾਲੇ ਵਰਤੇ ਜਾਂਦੇ ਹਨ ਉਹਨਾਂ ਨਾਲ ਹੀ ਉਹ ਇੱਕ ਵਧੀਆ ਚੀਜ਼ ਬਣਦੀ ਹੈ ਹੈ ਨਾ ਅਤੇ ਵਰਤੇ ਜਾਣ ਮਸਾਲੇ ਜਿਵੇਂ ਜੀਰਾ ਧਨੀਆ ਅਤੇ ਕਾਲੀ ਮਿਰਚ ਹੋ ਗਈ ਕੜ੍ਹੀ ਪੱਤਾ ਹੋ ਗਿਆ ਤੇਜ਼ ਪੱਤਾ ਹੋ ਗਿਆ ਇਹ ਸਾਡੀ ਸਿਹਤ ਲਈ ਵੀ ਬਹੁਤ ਬੈਨੀਫਿੱਟ ਹਨ ਜੇ ਕੁਝ ਅਜਿਹੀਆਂ ਚੀਜ਼ਾਂ ਹਨ ਵੀ ਜਿਹੜੀਆਂ ਸਾਨੂੰ ਖਾਣ ਨੂੰ ਖਰਾਬ ਵੀ ਕਰਦੀਆਂ ਹਨ ਜਿਵੇਂ ਬੈ ਬਾਦੀ ਕਰਦੀਆਂ ਹਨ ਅਤੇ ਇਹ ਮਸਾਲੇ ਪਾਉਣ ਨਾਲ ਜਿਹੜੀਆਂ ਸਬਜ਼ੀਆਂ ਹੈ ਤਾਂ ਸਰੀਰ ਲਈ ਬਹੁਤ ਹੀ ਲਾਭਦਾਇਕ ਬਣ ਜਾਂਦੀਆਂ ਹਨ ਜਿਵੇਂ ਕੜ੍ਹੀ ਪੱਤਾ ਹੋ ਗਿਆ ਉਹਦੇ ਬਹੁਤ ਬੈਨੀਫਿਟ ਹਨ ਇਹ ਅਤੇ ਤੇਜ਼ ਪੱਤਾ ਹੋ ਗਿਆ ਇਲੈਚੀ ਹੋ ਗਈ ਛੋਟੀ ਇਲੈਚੀ ਲੌਂਗ ਇਹ ਸਾਰੇ ਮਸਾਲੇ ਹੈ ਸਬਜ਼ੀਆਂ ਨੂੰ ਬਹੁਤ ਹੀ ਸਰੀਰ ਲਈ ਠੀਕ ਬਣਾਉਂਦੇ ਹਨ